ਮੇਰੀ ਮਨਪਸੰਦ ਗੇਮ ਰੱਸਾਕੱਸੀ ਹੈ ਅਤੇ ਜਦੋਂ ਇਹ ਮੈਨੂੰ ਇਸ ਕਰਕੇ ਪਸੰਦ ਹੈ ਕਿ ਜਦੋਂ ਵੀ ਅਸੀਂ ਖੇਡਦੇ ਹਾਂ ਤਾਂ ਪੂਰਾ ਜ਼ੋਰ ਹੋਸ਼ੋ ਹਵਾਸ਼ 'ਚ ਆਪਣਾ ਸਰੀਰ ਦੀ ਮੂਵਮੈਂਟ ਕਰਦੇ ਹਾਂ ਜਿਸ ਨਾਲ ਕਿ ਜਿਸ ਨਾਲ ਕਿ ਹੈ ਨਾ ਸਾਡੀ ਗੇਮ ਦੇ ਵਿੱਚ ਮਜ਼ਾ ਆਉਂਦਾ ਹੈ ਅਤੇ ਖੇਡਣ ਨੂੰ ਵੀ ਦਿਲਚਸਪ ਲੱਗਦਾ ਹੈ ਜਦੋਂ ਗੇਮ ਖੇਡਦੇ ਹਾਂ ਤਾਂ ਉਸ ਸਮੇਂ ਇਹ ਨਹੀਂ ਦੇਖਿਆ ਜਾਂਦਾ ਕਿ ਕੌਣ ਵੱਡਾ ਹੈ ਜਾਂ ਛੋਟਾ ਬਸ ਗੇਮ ਵੱਲ ਧਿਆਨ ਦਿੱਤਾ ਜਾਂਦਾ ਜਦੋਂ ਗੇਮ ਕਿਉਂਕਿ ਰੱਸਾਕੱਸੀ ਦੇ ਵਿੱਚ ਦਸ ਤੋਂ ਬਾਰਾਂ ਜਣਿਆਂ ਦੀ ਟੀਮ ਹੁੰਦੀ ਹੈ ਤਾਂ ਜੋ ਉਹ ਖੇਡ ਕੇ ਆ ਆਪਣਾ ਮੰਨੋਰੰਜਨ ਕਰ ਸਕਣ ਜਦੋਂ ਗੇਮ ਖੇਡਦੇ ਹਾਂ ਮੈਨੂੰ ਇਹ ਗੇਮ ਬਹੁਤ ਵਧੀਆ ਲੱਗਦੀ ਆ ਕਿਉਂਕਿ ਇਸ ਵਿੱਚ ਮੇਰੀ ਪੂਰੀ ਬੋਡੀ ਦੀ ਮੂਵਮੈਂਟ ਹੁੰਦੀ ਹੈ ਤਾਂ ਜੋ ਮੈਂ ਆਪਣੇ ਸਰੀਰ ਨਾਲ ਸਰੀਰ ਦੇ ਪ੍ਰਤੀ ਵੀ ਧਿਆਨ ਰੱਖਦੀ ਹਾਂ ਕਿਉਂਕਿ ਗੇਮ ਖੇਡਦੇ ਸਮੇਂ ਮੈਨੂੰ ਇਹ ਵੀ ਆਪਣੇ ਧਿਆਨ ਰੱਖਣਾ ਪੈਂਦਾ ਹੈ ਕਿ ਅੱਗੇ ਵਾਲੇ ਦੀ ਕੋਈ ਨੁਕਸਾਨ ਨਾ ਹੋ ਜਾਵੇ ਅਤੇ ਮੇਰਾ ਵੀ ਕੋਈ ਨੁਕਸਾਨ ਨਾ ਹੋ ਜਾਵੇ ਕਿਉਂਕਿ ਰੱਸਾਕੱਸੀ ਦੇ ਟਾਈਮ ਵਿੱਚ ਜਦੋਂ ਜ਼ੋਰ ਲਾਇਆ ਜਾਂਦਾ ਹੈ ਤਾਂ ਗਿਰਨ ਦਾ ਡਰ ਜ਼ਿਆਦਾ ਰਹਿੰਦਾ ਹੈ ਪਰ ਫਿਰ ਵੀ ਬਚਾਅ ਕਰਕੇ ਆਪਣੀ ਗੇਮ ਪੂਰੀ ਕੀਤੀ ਜਾਂਦੀ ਹੈ ਤਾਂ ਜੋ ਇਸ ਨੂੰ ਪੂਰੀ ਕਰਕੇ ਫਿਰ ਗੇਮ ਨੂੰ ਵਧੀਆ ਲੱਗਦਾ ਹੈ ਅਤੇ ਜਿੱਤਣ ਦਾ ਵੀ ਮੌਕਾ ਮਿਲਦਾ ਹੈ ਕਿਉਂਕਿ ਅੱਜ ਕੱਲ੍ਹ ਦੇ ਟਾਈਮ ਵਿੱਚ ਰੱਸਾਕੱਸੀ ਬਹੁਤ ਘੱਟ ਗਈ ਹੈ ਪਰ ਮੇਰੀ ਮਨਪਸੰਦ ਖੇਡ ਸ਼ੁਰੂ ਤੋਂ ਹੀ ਰੱਸਾਕੱਸੀ ਰਹੀ ਹੈ